ਹੈਲੋ ਹਾਂਜੀ ਸਰ ਅ ਅਨੇਜਾ ਸਵੀਟਸ ਤੋਂ ਗੱਲ ਕਰ ਰਹੇ ਹੋ ਸਰ ਮੈਂ ਸਤਪਿੰਦਰ ਸਿੰਘ ਬੋਲ ਰਿਹਾ ਸੀ ਅੱਜ ਮੈਂ ਸਵੇਰੇ ਤੁਹਾਨੂੰ ਲੰਚ ਦਾ ਔਡਰ ਦਿੱਤਾ ਸੀਗਾ ਨਾ ਹਾਂਜੀ ਸਰ ਛੋਟੀ ਜਿਹੀ ਰਿਕੁਐਸਟ ਸੀਗੀ ਜਿਹੜਾ ਮੈਂ ਤੁਹਾਨੂੰ ਐਡਰੈਸ ਦਿੱਤਾ ਸੀਗਾ ਨਾ ਸਵੇਰੇ ਉਹ ਮੈਂ ਐਡਰੈਸ ਤੁਹਾਨੂੰ ਦਿੱਤਾ ਸੀਗਾ ਅਰਬਨ ਅਸਟੇਟ ਫੇਸ ਵੰਨ ਦਾ ਹਾਂਜੀ ਹਾਂਜੀ ਅਰਬਨ ਅਸਟੇਟ ਐੱਚ ਆਈ ਜੀ ਛੇ ਸੌ ਪਝੱਤਰ ਮੇਰਾ ਹੈ ਨਾ ਤੁਹਾਨੂੰ ਐਡਰੈਸ ਦਿੱਤਾ ਸੀਗਾ ਹਾਂ ਸਰ ਮੇਰੀ ਰਿਕੁਐਸਟ ਇਹ ਹੈ ਜੀ ਕਿ ਮੈਂ ਨਾ ਥੋੜ੍ਹਾ ਜਿਹਾ ਪਲੈਨ ਚੇਂਜ ਕੀਤਾ ਪਹਿਲਾਂ ਤਾਂ ਮੈਂ ਔਰ ਮੇਰੇ ਫਰੈਂਡਸ ਨੇ ਅਰਬਨ ਅਸਟੇਟ ਇਕੱਠੇ ਹੋਣਾ ਸੀਗਾ ਬਟ ਹੁਣ ਮੈਂ ਨਾ ਐਡਰੈਸ ਖਾਲਸਾ ਕੋਲੇਜ ਕਲੋਨੀ ਦਾ ਦੇਣਾ ਹਾਂ ਥੋੜ੍ਹਾ ਜਿਹਾ ਪਲੈਨ 'ਚ ਚੇਂਜ ਆ ਤਾਂ ਪਲੀਜ਼ ਜਿਹੜਾ ਵੀ ਮੇਰਾ ਲੰਚ ਹੈ ਉਹ ਖਾਲਸਾ ਕੋਲੇਜ ਕਲੋਨੀ ਫਲੈਟ ਨੰਬਰ ਦੋ ਸੌ ਤਰਤਾਲੀ 'ਚ ਮੈਨੂੰ ਡਿਲੀਵਰ ਕਰ ਦਿਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੋਊਗਾ ਜੀ ਅਤੇ ਪੇਮੈਂਟ ਹਾਫ ਪੇਮੈਂਟ ਮੈਂ ਹਾਫ ਪੇਮੈਂਟ ਮੈਂ ਕਰਤੀ ਸੀਗੀ ਹਾਫ ਮੈਂ ਜਦੋਂ ਵੀ ਡਿਲੀਵਰੀ ਮੈਨ ਇੱਥੇ ਆਊਗਾ ਉਹਨੂੰ ਕਰ ਦੂੰਗਾ ਬਹੁਤ ਬਹੁਤ ਸ਼ੁਕਰੀਆਂ ਸਰ ਥੈਂਕ ਯੂ ਥੈਂਕ ਯੂ ਵੈਰੀ ਮੱਚ